ਇੰਟਰਨੈੱਟ ਸਾਨੂੰ ਬੈਂਕ ਨੀਤੀਆਂ ਬਾਰੇ ਜਾਣਕਾਰੀ ਦੇਣ ਲਈ ਕਾਫੀ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਆਮ ਜਨਤਾ ਦੇ ਕੋਲ ਟਾਈਮ ਦੀ ਕਾਫੀ ਘਾਟ ਹੈਗੀ ਹੈ ਕਿਉਂਕਿ ਬੈਂਕਾਂ ਦੇ ਵਿੱਚ ਲੰਬੀਆਂ ਕਤਾਰਾਂ ਹੋਣ ਦੇ ਬਾਵਜੂਦ ਆਮ ਜਨਤਾ ਕੋਲ ਸਮੇਂ ਦੀ ਵੀ ਪਾਬੰਦੀ ਹੋਣ ਦੇ ਕਾਰਨ ਜਾਂ ਸਮੇਂ ਦੀ ਘਾਟ ਹੋਣ ਦੇ ਕਾਰਨ ਆਮ ਜਨਤਾ ਬੈਂਕਾਂ ਦੇ ਵਿੱਚ ਨਹੀਂ ਜਾ ਸਕਦੀ ਜਿਸ ਕਰਕੇ ਅਲੱਗ ਅਲੱਗ ਬੈਂਕਾਂ ਨੇ ਅੱਜ ਦੇ ਟਾਈਮ ਆਪਣੇ ਆਪਣੇ ਐਪ ਬਣਾ ਲਏ ਹਨ ਜਿਵੇਂ ਕਿ ਸਟੇਟ ਬੈਂਕ ਔਫ ਇੰਡੀਆ ਵਾਲਿਆਂ ਨੇ ਯੋਨੋ ਐੱਸ ਬੀ ਆਈ ਦਾ ਐਪ ਬਣਾ ਲਿਆ ਹੈ ਜਿਸਦੇ ਕਾਰਨ ਆਮ ਜਨਤਾ ਨੂੰ ਕਾਫੀ ਆਸਾਨੀ ਹੋਈ ਹੈ ਅਤੇ ਆਮ ਜਨਤਾ ਯੋਨੋ ਐੱਸ ਬੀ ਆਈ ਤੋਂ ਆਪਣੀ ਸਰਵਿਸ ਲੈ ਸਕਦੀ ਹੈ ਇਸਦੇ ਨਾਲ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਵਾਲਿਆਂ ਨੇ ਵੀ ਆਪਣਾ ਪੀ ਐੱਨ ਬੀ ਦਾ ਐਪ ਬਣਾ ਲਿਆ ਹੈ ਜਿਸਦੇ ਨਾਲ ਆਮ ਜਨਤਾ ਨੂੰ ਔਨਲਾਈਨ ਕੰਮ ਕਰਨ ਦੀ ਸੁਵਿਧਾ ਦੇ ਦਿੱਤੀ ਹੈ ਅਤੇ ਕਾਫੀ ਆਸਾਨੀ ਕਰ ਦਿੱਤੀ ਹੈ ਇਸਦੇ ਨਾਲ ਨਾਲ ਹੀ ਅਖ਼ਬਾਰਾਂ ਰਾਹੀਂ ਵੀ ਸਾਨੂੰ ਬੈਂਕ ਨੀਤੀਆਂ ਬਾਰੇ ਕਾਫੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਅਲੱਗ ਅਲੱਗ ਬੈਂਕਾਂ ਦਾ ਦੇ ਬਾਰੇ ਵਿਸਥਾਰਪੂਰਵਕ ਨਾਲ ਅਖ਼ਬਾਰਾਂ ਦੇ ਵਿੱਚ ਵੀ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਜੇ ਤੁਸੀਂ ਬੀਮਾ ਪੋਲੀਸੀ ਕਰਵਾਉਣੀ ਹੈ ਜਾਂ ਕੋਈ ਅਲੱਗ ਅਲੱਗ ਬੈਂਕਾਂ ਦੇ ਵਿੱਚ ਖਾਤੇ ਖੁਲਵਾਉਣੇ ਨੇ ਤਾਂ ਕਿ ਕਿਹੜੇ ਕਿਹੜੇ ਬੈਂਕਾਂ 'ਚ ਖੁਲਵਾਉਣੇ ਨੇ ਅਤੇ ਕਿਸ ਤਰੀਕੇ ਨਾਲ ਖੁਲਵਾਉਣੇ ਨੇ